ਮੇਰੀਆਂ ਬਚਪਨ ਦੀਆਂ ਮਨਮੋਹਕ ਯਾਦਾਂ ਇੱਕ ਵਾਰ ਅਸੀਂ ਹਰਿਮੰਦਰ ਸਾਹਿਬ ਲਈ ਤਿਆਰੀ ਕੀਤੀ ਅਤੇ ਮੈਂ ਅਤੇ ਮੇਰੀ ਫੈਮਿਲੀ ਅਤੇ ਮੇਰੇ ਫ੍ਰੈਂਡ ਸਰਕਲ ਅਸੀਂ ਇੱਥੋਂ ਸੱਤ ਵਜੇ ਟਰੇਨ ਫੜ ਲਈ ਅਤੇ ਅਸੀਂ ਸਿੱਧਾ ਅੰਮ੍ਰਿਤਸਰ ਪੁੱਜੇ ਅੰਮ੍ਰਿਤਸਰ ਤੋਂ ਫਰੀ ਬੱਸਾਂ ਦੀ ਸੇਵਾ ਲੱਗੀ ਹੋਈ ਸੀ ਜਿਹਦੇ ਵਿੱਚ ਅਸੀਂ ਸਾਰੇ ਬੈਠ ਗਏ ਬੈਠ ਕੇ ਅਸੀਂ ਰਸਤੇ ਵਿੱਚ ਬੱਸ ਵਿੱਚ ਬੈਠ ਕੇ ਬਹੁਤ ਨਜਾਰੇ ਲਏ ਅਤੇ ਅਸੀਂ ਹੌਲ਼ੀ ਹੌਲ਼ੀ ਦੇਖਦੇ ਸਾਰਾ ਕੁਛ ਦੇਖਦੇ ਦੇਖਦੇ ਬੱਸ ਵਿੱਚ ਹਰਿਮੰਦਰ ਸਾਹਿਬ ਪਹੁੰਚੇ ਉੱਥੇ ਪਹੁੰਚ ਕੇ ਉੱਥੇ ਦਾ ਮਨਮੋਹਕ ਨਜ਼ਾਰਾ ਬਹੁਤ ਮਜ਼ਾ ਆਇਆ ਮੇਨ ਇਹ ਹੈ ਵੀ ਸਾਡਾ ਸਾਰਾ ਪਰਿਵਾਰ ਅਤੇ ਮੇਰੀ ਫ੍ਰੈਂਡ ਵੀ ਨਾਲ਼ ਸੀ ਉਹਦੇ ਨਾਲ਼ ਹੋਰ ਵੀ ਜ਼ਿਆਦਾ ਵਧੀਆ ਲੱਗਿਆ ਅਤੇ ਅਸੀਂ ਸਾਰੇ ਜਣੇ ਹਰਿਮੰਦਰ ਸਾਹਿਬ ਪਹੁੰਚ ਕੇ ਪਹਿਲਾਂ ਤਾਂ ਅਸੀਂ ਆਪਣਾ ਸਮਾਨ ਜਮ੍ਹਾ ਕਰਵਾਇਆ ਅਤੇ ਅਸੀਂ ਸਰੋਵਰ ਵਿੱਚ ਨਹਾਏ ਉਸ ਤੇ ਬਾਅਦ ਅਸੀਂ ਫ੍ਰੈਸ਼ ਹੋ ਕੇ ਅਸੀਂ ਹਰਿਮੰਦ ਮੱਥਾ ਟੇਕਣ ਵਾਸਤੇ ਲਾਈਨਾਂ ਵਿੱਚ ਲੱਗ ਗਏ ਲਾਈਨਾਂ ਵਿੱਚ ਲੱਗ ਕੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਐਡੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਅਸੀਂ ਹੌਲ਼ੀ ਹੌਲ਼ੀ ਹੌਲ਼ੀ ਹੌਲ਼ੀ ਸਾਡੀ ਵਾਰੀ ਆ ਗਈ ਅਸੀਂ ਮੱਥਾ ਟੇਕਿਆ ਮੱਥਾ ਟੇਕ ਕੇ ਅਸੀਂ ਬਾਹਰ ਆਏ ਬਾਹਰ ਆ ਕੇ ਅਸੀਂ ਲੰਗਰ ਛੱਕਿਆ ਲੰਗਰ ਛੱਕਿਆ ਅਸੀਂ ਬੈ ਕਤਾਰਾਂ ਵਿੱਚ ਬੈਠ ਕੇ ਅਸੀਂ ਲੰਗਰ ਛੱਕਿਆ ਉਸ ਟਾਈਮ ਵੀ ਬਹੁਤ ਆਨੰਦ ਆਇਆ ਜਿਹੜਾ ਨੀਚੇ ਬੈਠ ਕੇ ਖਾਣ ਦਾ ਆਨੰਦ ਆਉਂਦਾ ਏ ਉਹ ਬਹੁਤ ਵਧੀਆ ਸੀਗਾ ਉਹ ਉਸ ਤੋਂ ਬਾਅਦ ਅਸੀਂ ਬੱਸ ਲਿੱਤੀ ਬੱਸ ਲੈ ਕੇ ਅਸੀਂ ਸਾਰੇ ਜਣੇ ਵਾਘਾ ਬਾਡਰ ਵੀ ਦੇਖਿਆ ਅਤੇ ਜਲ੍ਹਿਆਂਵਾਲ਼ਾ ਬਾਗ ਵੀ ਦੇਖਿਆ ਉਸ ਤੋਂ ਬਾਅਦ ਅਸੀਂ ਬਹੁਤ ਸਾਰੇ ਜਿਹੜੇ ਗੁਰਦੁਆਰੇ ਸੀ ਉਹ ਉਹ ਨ ਉੱਥੇ ਵੀ ਗਏ ਉੱਥੇ ਵੀ ਮੱਥਾ ਟੇਕਿਆ ਮੇਨ ਇਹ ਹੈ ਵੀ ਅਸੀਂ ਬਹੁਤ ਜ਼ਿਆਦਾ ਇੰਨਜੋਏ ਕੀਤਾ ਉਹ ਮੇਰੀ ਬਚਪਨ ਦੀ ਸਭ ਤੋਂ ਬੜੀ ਯਾਦ ਹੈ ਜਿਹੜੀ ਅਸੀਂ ਮੈਂ ਆਪਣੀ ਫੈਮਿਲੀ ਔਰ ਆਪਣੇ ਦੋਸਤਾਂ ਦੇ ਨਾਲ਼ ਬਿਤਾਈ